ਪੰਜਾਬ ਰਾਜ ਦੇ ਵਿੱਚ ਜਿੱਥੇ ਕਲਾ ਅਤੇ ਸ਼ਿਲਪਕਾਰੀ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਤਰਫ ਇੱਥੇ ਲੱਕੜ ਦੇ ਉੱਪਰ ਮੀਨਾਕਾਰੀ ਅਤੇ ਸ਼ਿਲਪਕਾਰੀ ਦਾ ਕੰਮ ਹੁੰਦਾ ਹੈ ਅਤੇ ਉਹ ਬਹੁਤ ਵਿਸ਼ਵ ਪ੍ਰਸਿੱਧ ਹੈਗਾ ਉਸ ਤਰੀਕੇ ਦੇ ਨਾਲ ਪੰਜਾਬ ਰਾਜ ਦੇ ਵਿੱਚ ਫੁਲਕਾਰੀ ਅਤੇ ਹੋਰ ਕਈ ਕਢਾਈਆਂ ਪ੍ਰਸਿੱਧ ਹਨ ਜੇ ਆਪਾਂ ਗੱਲ ਕਰੀਏ ਸਾਡੇ ਖੇਤਰ ਫ਼ਾਜ਼ਿਲਕਾ ਦੀ ਤਾਂ ਸਾਡੇ ਖੇਤਰ ਦੇ ਵਿੱਚ ਜੁੱਤੀ ਦੇ ਉੱਪਰ ਕਲਾਕਾਰੀਆਂ ਦਾ ਬਹੁਤ ਹੀ ਅੱਛਾ ਕੰਮ ਕੀਤਾ ਜਾਂਦਾ ਹੈ ਉਹ ਕਈ ਪ੍ਰਕਾਰ ਦੇ ਸਿਲਕ ਦੇ ਧਾਗਿਆਂ ਨਾਲ ਅਤੇ ਹੋਰ ਕਈ ਜਿਹੜੇ ਧਾਗੇ ਹੁੰਦੇ ਨੇ ਉਹਨਾਂ ਵਾਸਤੇ ਪ੍ਰਯੋਗ ਕਰਕੇ ਕੀਤਾ ਜਾਂਦਾ ਹੈ ਇਹ ਕੰਮ ਪੰਜਾਬ ਦੀ ਜਿਹੜੀ ਸੱਭਿਆਚਾਰਕ ਪਹਿਚਾਣ ਹੈ ਪੰਜਾਬ ਦੀ ਜਿਹੜੇ ਫੋਕ ਕੱਪੜੇ ਨੇ ਜਿਹੜੇ ਇੱਥੋਂ ਦੇ ਸੱਭਿਆਚਾਰਕ ਕੱਪੜੇ ਨੇ ਉਹਨਾਂ ਦੇ ਵਿੱਚ ਜੁੱਤੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੁੰਦਾ ਹੈ ਅਤੇ ਉਸ ਵਿੱਚ ਸਾਡਾ ਖੇਤਰ ਬਹੁਤ ਸਹਿਯੋਗ ਕਰ ਰਿਹਾ ਹੈ